ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਯੋਗਾ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਯੋਗ ਅਭਿਆਸ ਕਰਨ ਨਾਲ ਅਸੀਂ ਸਰੀਰਕ ਪੱਖੋਂ ਸਿਹਤਮੰਦ ਤਾਂ ਹੁੰਦੇ ਹੀ ਹਾਂ ਬਲਕਿ ਮਾਨਸਿਕ ਤੌਰ 'ਤੇ ਵੀ ਮਜ਼ਬੂਤ ਹੁੰਦੇ ਹਨ ਇਸ ਨਾਲ ਸਾਡਾ ਮਨ ਵੀ ਸਥਿਰ ਹੁੰਦਾ ਹੈ ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗਾ ਦਾ ਬਹੁਤ ਵੱਡਾ ਰੋਲ ਹੈ ਯੋਗਾ ਅਭਿਆਸ ਕਰਨ ਨਾਲ ਅਸੀਂ ਸਰੀਰਕ ਪੱਖੋਂ ਸਿਹਤਮੰਦ ਹੁੰਦੇ ਹਨ ਜ਼ਿਲ੍ਹਾ ਪ੍ਰਸ਼ਾਸਨ ਨੇ ਯੋਗਾ ਲਈ ਬਹੁਤ ਸਾਰੇ ਸ਼ਿਵਰ ਲਗਾਏ ਹਨ ਜਿਸ ਨਾਲ ਲੋਕਾਂ ਨੂੰ ਫਰੀ ਯੋਗਾ ਦਿੱਤੀਆਂ ਜਾਂਦੀਆਂ ਹਨ ਉਹਨਾਂ ਕਿਹਾ ਕਿ ਸਵੇਰੇ ਸਵੇਰੇ ਯੋਗਾ ਕਰਨ ਨਾਲ ਸਾਡਾ ਮਨ ਵਿੱਚ ਸਕਾਰਾਤਮਕ ਵਿਚਾਰਾਂ ਦਾ ਅਦਾਨ ਪ੍ਰਦਾਨ ਹੁੰਦਾ ਹੈ ਉੱਥੇ ਸਰੀਰ ਵੀ ਸਿਹਤਮੰਦ ਬਣਦਾ ਹੈ ਯੋਗਾ ਕਰਨ ਨਾਲ ਸਾਰਾ ਦਿਨ ਸਾਡੇ ਸਰੀਰ ਵਿੱਚ ਤਾਜ਼ਗੀ ਰਹਿੰਦੀ ਹੈ ਅਤੇ ਬਹੁਤ ਬਹੁਤ ਪੁਰਾਣੀਆਂ ਅੰਦਰੂਨੀ ਬਿਮਾਰੀਆਂ ਅਤੇ ਨਵੀਆਂ ਬਿਮਾਰੀਆਂ ਦੇ ਪੈਦਾ ਹੋਣ ਤੋਂ ਵੀ ਛੁਟਕਾਰਾ ਮਿਲਦਾ ਹੈ ਸਾਡਾ ਸਰੀਰ ਬਹੁਤ ਹੀ ਅਨਮੋਲ ਹੈ ਇਸਨੂੰ ਅਜਾਈਂ ਨਹੀਂ ਗਵਾਉਣਾ ਚਾਹੀਦਾ ਅਤੇ ਇਸ ਨੂੰ ਸਾਂਭ ਕੇ ਰੱਖਣਾ ਬਹੁਤ ਜ਼ਰੂਰੀ ਹੈ ਯੋਗਾ ਕਰਨ ਨਾਲ ਸਰੀਰ ਅੰਦਰ ਸ਼ੁੱਧ ਹਵਾ ਦਾ ਗਿਨ ਹੁੰਦਾ ਹੈ ਆਸਣ ਦਾ ਆਪਣਾ ਆਪਣਾ ਫਾਇਦਾ ਹੈ ਅਤੇ ਹਰ ਕਿਸੇ ਨੂੰ ਰੋਜ਼ਾਨਾ ਅੱਧੇ ਤੋਂ ਲੈ ਕੇ ਇੱਕ ਘੰਟਾ ਯੋਗਾ ਜ਼ਰੂਰ ਕਰਨੀ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਫਿਟ ਕਰਨ ਵਿੱਚ ਆਪਣਾ ਟਾਈਮ ਜ਼ਰੂਰ ਦੇਣਾ ਚਾਹੀਦਾ ਹੈ ਜੇ ਅਸੀਂ ਯੋਗਾ ਨੂੰ ਆਪਣੀ ਰੋਜ਼ ਜਾਂ ਰੋਜ਼ ਦੇ ਦਰ ਵਿੱਚ ਪਾ ਲਿਆ ਜਾਵੇ ਤਾਂ ਅਸੀਂ ਬਤੌਰ ਇੱਕ ਅੱਛੇ ਇਨਸਾਨ ਦੇ ਨਾਲ ਨਾਲ ਇੱਕ ਸਿਹਤ ਦੇ ਪੱਖੋਂ ਵੀ ਬਹੁਤ ਵੱਡੇ ਮਜ਼ਬੂਤ ਗਿਆਨੀ ਬਣਾਂਗੇ ਯੋਗ ਸਾਨੂੰ ਸਿਹਤਮੰਦ ਦੇ ਨਾਲ ਨਾਲ ਮਾਨਸਿਕ ਰੂਪ 'ਤੇ ਵੀ ਤੰਦਰੁਸਤ ਕਰਦਾ ਹੈ